ਹਰ ਰਾਜ ਵਿੱਚ ਸਿੱਖਿਆ ਪ੍ਰਣਾਲੀ ਹੋਵੇ ਜਾਂ ਕੁਛ ਵੀ ਹੋਵੇ ਜਿਹੜੀ ਉਹਨਾਂ ਦੀ ਭਾਸ਼ਾ ਹੁੰਦੀ ਮਾਤ ਭਾਸ਼ਾ ਉਹ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਾਡੇ ਪੰਜਾਬ ਵਿੱਚ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਬੱਚੇ ਦੇ ਜਨਮ ਤੋਂ ਲੈ ਕੇ ਉਹਦੇ ਅੰਤ ਤਕ ਸਿਰਫ ਇੱਕ ਮਾਤ ਭਾਸ਼ਾ ਹੀ ਹੈ ਜਿਹਦੇ ਵਿੱਚ ਉਹ ਆਪਣੀਆਂ ਸਾਰੀਆਂ ਗਲਤੀਆਂ ਆਪਣੇ ਸਾਰੇ ਵੱਲ ਵਲੇਵੇ ਜੋ ਉਹਦੇ ਮਨ ਦੇ ਚਾਅ ਨੇ ਉਹ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਮਾਤ ਭਾਸ਼ਾ ਦੇ ਵਿੱਚ ਕਿਸੇ ਨੂੰ ਸਮਝਾ ਸਕਦਾ ਇੱਕ ਛੋਟਾ ਬੱਚਾ ਜਿਹਦੀ ਭਾਸ਼ਾ ਕਿਸੇ ਨੂੰ ਸਮਝ ਨਹੀਂ ਆਉਂਦੀ ਉਹਦੀ ਭਾਸ਼ਾ ਕਿਹਨੂੰ ਸਮਝ ਆਉਂਦੀ ਉਹਦੀ ਮਾਤਾ ਨੂੰ ਇਵੇਂ ਹੀ ਮਾਤ ਭਾਸ਼ਾ ਦੇ ਵਿੱਚ ਕੋਈ ਵੀ ਬੱਚਾ ਭਾਵੇਂ ਕਿੰਨੀਆਂ ਵੱਡੀਆਂ ਪੜ੍ਹਾਈਆਂ ਕਰ ਲਿਆ ਉਹਨੂੰ ਕੋਈ ਵੀ ਹੋਰ ਲੈਂਗੁਏਜ ਜੇ ਨਹੀਂ ਪਤਾ ਚੱਲ ਰੀ ਆਪਣੀ ਮਾਤ ਭਾਸ਼ਾ ਵਿੱਚ ਜਦੋਂ ਉਹ ਕੁਛ ਵੀ ਲਿਖੇਗਾ ਅਤੇ ਉਹਦੀ ਸਾਰੀ ਗੱਲ ਉਹਦਾ ਅਧਿਆਪਕ ਬੜੇ ਸੋਹਣੇ ਤਰੀਕੇ ਸਮਝਦਾ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹਦੇ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ ਹਰ ਬੱਚਾ ਜਿਹੜੋ ਪੜ੍ਹਨ ਨੂੰ ਜਾਂਦਾ ਹੈ ਅਤੇ ਉਹਦੀ ਹਰ ਟਾਈਪ ਦੀ ਜਿਹੜੀ ਪੜ੍ਹਾਈ ਹੈ ਉਹਨੂੰ ਮਾਤ ਭਾਸ਼ਾ 'ਚ ਰੱਖਿਆ ਤਾਂ ਕਿ ਉਹਨੂੰ ਪੜ੍ਹਨ ਵਿੱਚ ਸਮਝਣ ਵਿੱਚ ਲਿਖਣ ਵਿੱਚ ਕੋਈ ਮੁਸ਼ਕਿਲ ਨਾ ਆਵੇ ਪੰਜਾਬੀ ਦੀ ਮਾਤ ਭਾਸ਼ਾ ਇਹੋ ਜਿਹੀ ਭਾਸ਼ਾ ਹੈ ਜਿਹੜਾ ਹਰ ਇੱਕ ਬੜੇ ਅਰਾਮ ਦੇ ਨਾਲ ਸਮਝ ਸਕਦਾ ਹੈ ਆਪਣੀ ਗੱਲ ਸਮਝਾ ਸਕਦਾ ਹੈ ਅਤੇ ਦੂਸਰੇ ਨੂੰ ਆਪਣੀ ਗੱਲ ਦੇ ਨਾਲ ਸਮਝਾ ਸਕਦਾ ਹੈ